ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਸਰ ਯਸ ਸਰ ਹਾਂਜੀ ਸਰ ਮੈਂ ਜੋਬ ਲੱਭ ਰਿਹਾ ਐ ਜੀ ਮੇਰੇ ਕੋਲ ਪੰਜ ਸਾਲਾਂ ਦਾ ਪੁਰਾਣਾ ਐਕਸਪੀਰੀਅਂਸ ਵੀ ਆ ਸਵਰਾਜ ਕੰਪਨੀ ਦਾ ਪੁਰਾਣੀ ਦਾ ਤੇ ਮਤਲਬ ਕਿ ਮੈਂ ਸੈਲਰੀ ਬਾਰੇ ਪੁੱਛਣਾ ਸੀਗਾ ਸਰ ਹਾਂਜੀ ਹਾਂਜੀ ਪੁਰਾਣਾ ਪਿਛਲਾ ਐਕਸਪੀਰੀਅਂਸ ਆ ਪੰਜ ਸਾਲ ਦਾ ਮੇਰੇ ਕੋਲ ਹਾਂਜੀ ਸਰ ਵੈਸੇ ਹੀ ਸਰ ਕੰਪਨੀ ਨੇ ਨਾ ਮਤਲਬ ਕਿ ਨਿਊ ਇਪਲੋਈ ਰੱਖਣੇ ਤੇ ਤੇ ਉਹਦੇ ਕਰਕੇ ਜਿਹੜਾ ਟਾਈਮ ਪੀਰੀਅਡ ਤਾ ਉਹ ਓਵਰ ਹੋ ਗਿਆ ਸੀਗਾ ਪੁਰਾਣੇ ਇਮਪਲੋਈਜ ਦਾ ਹਾਂਜੀ ਸਰ ਸਰ ਮੈਂ ਫੀਫਟੀ ਥਾਊਂਸੈਂਡ ਐਕਸ ਐਕਸਪੈਕਟ ਕਰਦਾ ਪੰਜਾਹ ਹਜਾਰ ਰੁਪਿਆ ਹਾਂਜੀ ਸਰ ਸਰ ਉੱਥੇ ਪੰਤਾਲੀ ਹਜ਼ਾਰ ਸੈਲਰੀ ਸੀਗੀ ਮੇਰੀ ਪਹਿਲਾਂ ਤੇ ਹਾਂਜੀ ਤੇ ਫੰਡ ਘੱਟ ਹੁੰਦੇ ਦੇ ਮੇਰੇ ਹਾਂਜੀ ਸਰ ਹਾਂਜੀ ਹਾਂਜੀ ਨਹੀਂ ਸਰ ਹੋਰ ਕੋਈ ਸੈਂਟੀਵ ਨਹੀਂ ਕੰਮ ਮਿਲਦਾ ਹੈਗਾ ਸਰ ਤੇ ਹੋਲੀਡੇ ਬਾਰੇ ਪੁੱਛਣਾ ਸੀਗਾ ਵੀ ਹੋਲੀਡੇ ਕਿੱਦਣ ਕਿੱਦਣ ਹਾਂਜੀ ਸਰ ਤੇ ਬਾਕੀ ਹਾਂਜੀ ਹਾਂਜੀ ਸਰ ਅੱਛਾ ਜੀ

ਅੱਛਾ ਜੀ ਤੇ ਸਰ ਦਿਵਾਲੀ ਬੋਨਸ ਤੇ ਹੋਰ ਕੋਈ ਇਨਸੈਂਟਿਵ ਵੀ ਮਿਲਦੇ ਆ ਇਮਪਲੋਈਜ ਨੂੰ ਹਾਂਜੀ ਸਰ ਅੱਛਾ ਸਰ ਠੀਕ ਐ ਸਰ ਸਰ ਹਾਂਜੀ ਤੇ ਸਰ ਹੋਰ ਕੋਈ ਫੈਮਲੀ ਫੈਸੀਲਿਟੀ ਹਾਂਜੀ ਸਰ ਹਾਂਜੀ ਸਰ ਠੀਕ ਹੈ ਸਰ ਤੇ ਹਾਂਜੀ ਤੇ ਸਰ ਸੈਲਰੀ ਤੁਸੀਂ ਪੱਕਾ ਸ਼ੋਰ ਆ ਤੁਸੀਂ ਫੀਫਟੀ ਥਾਉਂਸੈਂਡ ਸੈਲਰੀ ਦੇ ਸਕਦੇ ਆ ਮੇਰੇ ਕੋਲ ਪਹਿਲਾਂ ਪਿਛਲੀ ਕੰਪਨੀ ਦਾ ਪੰਜ ਸਾਲ ਦਾ ਐਕਸਪੀਰੀਅਂਸ ਵੀ ਹੈ ਸਰ ਹਾਂਜੀ ਸਰ ਤੁਸੀਂ ਫੀਫਟੀ ਥਾਉਂਸੈਂਡ ਮੈਂ ਐਕਸਪੈਕਟ ਕਰਦਾ ਮੈਨੂੰ ਉਨੀ ਸੈਲਰੀ ਉਹ ਚਾਹੀਦੀ ਐ ਸਰ

ਹਾਂਜੀ ਸਰ ਸਰ ਮੈਂ ਫਸਟ ਨਵੰਬਰ ਤੋਂ ਜੁਇਨਿੰਗ ਲਈ ਰੈਡੀ ਐ ਸਰ ਹਾਂਜੀ ਸਰ ਠੀਕ ਹੈ ਸਰ ਓਕੇ ਸਰ ਓਕੇ ਬਾਏ